ਅਸੀਂ ਆਪਣੇ ਪੌਦਿਆਂ ਨੂੰ ਉਗਾਉਣ ਲਈ ਕੁਝ ਰਤ ਰੇਸ ਰੇਤਲੀ ਮਿੱਟੀ ਲੈ ਕੇ ਉਸ ਵਿੱਚ ਕਾਲੀ ਮਿੱਟੀ ਨੂੰ ਮਿਲਾ ਕੇ ਇਕ ਫੁੱਟ ਡੇਢ ਫੁੱਟ ਦੀ ਡੂੰਘਾਈ ਅਤੇ ਗੁਡਾਈ ਕਰਕੇ ਉਸ ਵਿੱਚ ਕੁਝ ਖਾਦਾਂ ਪਾ ਕੇ ਨਵੇਂ ਪੌਦੇ ਉਘਾ ਲੈਂਦੇ ਹਾਂ ਜਿਸ ਵਿੱਚ ਫਲਦਾਰ ਦਰੱਖਤ ਸਬਜ਼ੀਆਂ ਅਤੇ ਹੋਰ ਫਲ ਫੁੱਲਦਾਰ ਪੌਦੇ ਪੈਦਾ ਕੀਤੇ ਜਾਂਦੇ ਆ ਇਸ ਵਿੱਚ ਕੁਝ ਰੂੜੀ ਦੀ ਖਾਦ ਪਾ ਕੇ ਵਧੀਆ ਔਰਗੈਨਿਕ ਸਬਜ਼ੀਆਂ ਵੀ ਤਿਆਰ ਕੀਤੀਆਂ ਜਾਂਦੀਆਂ ਹਨ ਇਸ ਵਿੱਚ ਕ ਕਈ ਪ੍ਰਕਾਰ ਗੰਡੋਇਆਂ ਦੀ ਖਾਦ ਤੋਂ ਵੀ ਤਿਆਰ ਕਰਕੇ ਦਰੱਖਤਾਂ ਦੇ ਛੋਟੇ ਪੌਦਿਆਂ ਵਿੱਚ ਪਾਈ ਜਾਂਦੀ ਹੈ ਜਿਸ ਨਾਲ ਉਹਨਾਂ ਦੀ ਗਰੋਥ ਵਿੱਚ ਵਾਧਾ ਹੁੰਦਾ ਹੈ ਲਗਭਗ ਤੀਹ ਦਿਨਾਂ ਵਿੱਚ ਗੋਬਰ ਤੋਂ ਤਿਆਰ ਕਰਕੇ ਖਾਦ ਪੌਦਿਆਂ ਵਿੱਚ ਪਾਉਣ ਨਾਲ ਵਧੀਆ ਵੱਧਦੇ ਫੁੱਲਦੇ ਹਨ ਜਿਸ ਵਿੱਚ ਲਗਭਗ ਇਹਨਾਂ ਦੀ ਉੱਚਾਈ ਦੋ ਤੋਂ ਤਿੰਨ ਫੁੱਟ ਉੱਚਾਈ ਹੋ ਜਾਂਦੀ ਹੈ ਇਸ ਵਿੱਚ ਸਬਜ਼ੀਆਂ ਦੀ ਵਧੀਆ ਪੈਦਾਵਾਰ ਹੁੰਦੀ ਹੈ ਕਈ ਪ੍ਰਕਾਰ ਦੇ ਬੂਟੇ ਜਿਵੇਂ ਪ ਆਪਣੇ ਸਫ਼ੈਦਾ ਹੋ ਗਿਆ ਜਾਮਣ ਹੋ ਗਈ ਡੇਕ ਟਾਲੀ ਉਹਨਾਂ ਦੇ ਵਿੱਚ ਪਾਉਣ ਨਾਲ ਕਈ ਪ੍ਰਕਾਰ ਦੀ ਖਾਦ ਤਿਆਰ ਕਰਕੇ ਵਧੀਆ ਫਲਦਾਰ ਬੂਟੇ ਵੀ ਪੈਦਾ ਕੀਤੇ ਜਾਂਦੇ ਹਨ ਇਸ ਵਿੱਚ ਕਈ ਪ੍ਰਕਾਰ ਦੀ ਰਸੇਲੀ ਮਿੱਟੀ ਅਤੇ ਹੋਰ ਜਲੋੜ ਮਿੱਟੀ ਦੇ ਮੇਲ ਨਾਲ ਵੀ ਆਪਣੇ ਪੌਦੇ ਪੈਦਾ ਕੀਤੇ ਜਾਂਦੇ ਹਨ ਜਿਸ ਵਿੱਚ ਕਈ ਪ੍ਰਕਾਰ ਦੇ ਸਬਜ਼ੀਆਂ ਦੇ ਬੂਟੇ ਵੀ ਭਿੰਡੀਆਂ ਫਲਦਾਰ ਹੋਰ ਵੀ ਪੈਦਾ ਕੀਤੇ ਜਾਂਦੇ ਹਨ